ਹੈਲੋ ਹਾਂਜੀ ਭਾਅ ਜੀ ਤੁਸੀਂ ਜਿਹੜਾ ਮੈਨੂੰ ਸੁਨੇਹਾ ਭੇਜਿਆ ਜਿਸ ਵਿੱਚ ਪਿੱਕ ਤੁਸੀਂ ਲਿਖਿਆ ਕਿ ਤੁਸੀਂ ਪਿਕਅੱਪ ਸਥਾਨ 'ਤੇ ਪਹੁੰਚ ਗਏ ਹੋ ਪਰ ਤੁਸੀਂ ਮੈਨੂੰ ਇੱਥੇ ਦਿਖ ਨਹੀਂ ਰਹੇ ਮੈਂ ਇੱਥੇ ਦੇਖੋ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਆ ਜੋ ਕਿ ਇਤਿਹਾਸਿਕ ਗੁਰਦੁਆਰਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਮੈਂ ਇੱਥੇ ਖੜ੍ਹੀ ਸੀ ਭਾਅ ਜੀ ਤੁਸੀਂ ਕਿੱਥੇ ਹੋ ਨਹੀਂ ਨਹੀਂ ਤੁਸੀਂ ਫਿਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਚਲੇ ਗਏ ਹੋ ਇਹ ਇੱਧਰ ਜਦੋਂ ਆਪਾਂ ਚੰਡੀਗੜ੍ਹ ਵਾਲੀ ਸਾਈਡ ਤੋਂ ਚੰਡੀਗੜ੍ਹ ਰੋਡ ਜਿਹੜਾ ਆ ਰਿਹਾ ਫਤਿਹਗੜ੍ਹ ਸਾਹਿਬ ਨੂੰ ਉਸ 'ਤੇ ਆ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਮੈਂ ਉੱਥੇ ਖੜ੍ਹੀ ਹਾਂ ਤੁਸੀਂ ਹਾਂਜੀ ਉੱਥੇ ਪਹੁੰਚ ਜਾਉ